ਉਨੱਤੀ ਜੂਨ ਦੋ ਹਜ਼ਾਰ ਦਸ ਇੱਕ ਅਪ੍ਰੈਲ ਦੋ ਹਜ਼ਾਰ ਨੌ ਦਸ ਮਈ ਉੱਨੀ ਸੌ ਨੱਬੇ ਦਸ ਜਨਵਰੀ ਉੱਨੀ ਸੌ ਇਕਾਨਵੇਂ ਚੌਦ੍ਹਾਂ ਦਸੰਬਰ ਦੋ ਹਜ਼ਾਰ ਦੋ